ਆਪ ਜੀ ਦੁਆਰਾ ਪੁੱਛੇ ਗਏ ਪ੍ਰਸ਼ਨ ਮੁਤਾਬਕ ਭਾਰਤ ਦੇ ਪੰਜ ਰਾਜਾਂ ਦੇ ਨਾਮ ਦੱਸਣੇ ਹਨ ਮੈਂ ਸਭ ਤੋਂ ਪਹਿਲਾਂ ਆਪਣੇ ਰਾਜ ਦਾ ਪੰਜਾਬ ਦਾ ਨਾਮ ਲੈਣਾ ਚਾਹੁੰਦਾ ਹਾਂ ਜਿਸ ਵਿੱਚ ਮੈਂ ਰਹਿੰਦਾ ਹਾਂ ਅਤੇ ਦੂਸਰੇ ਨੰਬਰ 'ਤੇ ਪੰਜਾਬ ਰਾਜ ਦਾ ਗਵਾਂਢੀ ਰਾਜ ਹਿਮਾਚਲ ਪ੍ਰਦੇਸ਼ ਤੀਜੇ ਨੰਬਰ 'ਤੇ ਪੰਜਾਬ ਰਾਜ ਦਾ ਗਵਾਂਢੀ ਰਾਜ ਹਰਿਆਣਾ ਅਤੇ ਚੌਥੇ ਨੰਬਰ 'ਤੇ ਪੰਜਾਬ ਦਾ ਗਵਾਂਢੀ ਰਾਜ ਦਿੱਲੀ ਅਤੇ ਚੌਥੇ ਨੰਬਰ 'ਤੇ ਮੈਂ ਭਾਰਤ ਦਾ ਰਾਜ ਮਹਾਰਾਸ਼ਟਰਾ ਦਾ ਨਾਂ ਲੈਣਾ ਚਾਹੁੰਦਾ ਹਾਂ ਅਤੇ ਸਭ ਤੋਂ ਅਖੀਰ ਵਿੱਚ ਮੈਂ ਭਾਰਤ ਦਾ ਕੇਰਲ ਰਾਜ ਦਾ ਨਾਂ ਲੈਣਾ ਚਾਹੁੰਦਾ ਹਾਂ